ਔਨਲਾਈਨ ਡਾਂਸ ਨੂੰ ਮੀਡੀਆ ਬਹੁਤ ਹੀ ਪਸੰਦ ਕਰਦਾ ਹੈ ਕਿਉਂਕਿ ਔਨਲਾਈਨ ਡਾਂਸ ਦੇ ਵਿੱਚ ਲੋਕ ਆਪਣੇ ਘਰ ਬੈਠੇ ਹੀ ਮਨੋਰੰਜਨ ਕਰ ਸਕਦੇ ਹਨ ਇਸ ਨਾਲ ਸਮਾਂ ਵੀ ਬਹੁਤ ਚੰਗਾ ਬੀਤਦਾ ਹੈ ਕਿਉਂਕਿ ਇਸ ਨਾਲ ਵਧੀਆ ਹੁੰਦਾ ਹੈ ਜੇ ਕਿਸੇ ਨੇ ਬਾਹਰ ਜਾਣਾ ਹੋਵੇ ਤਾਂ ਉਹ ਔਨਲਾਈਨ ਡਾਂਸ ਨੂੰ ਦੇਖ ਸਕਦਾ ਹੈ ਕਿਉਂਕਿ ਇਸ ਵਿੱਚ ਉਸਨੂੰ ਬਾਹਰ ਜਾਣ ਦੀ ਜ਼ਰੂਰਤ ਨਹੀਂ ਔਨਲਾਈਨ ਡਾਂਸ ਵਿੱਚ ਬਹੁਤ ਹੀ ਵਧੀਆ ਹੁੰਦਾ ਹੈ ਇਸ ਨਾਲ ਮੀਡੀਆ ਇਸ ਕਰਕੇ ਪ੍ਰਭਾਵਿਤ ਹੈ ਕਿਉਂਕਿ ਮੀਡੀਆ ਆਪਣੇ ਵਿਹਲੇ ਟਾਈਮ ਵਿੱਚ ਔਨਲਾਈਨ ਡਾਂਸ ਨੂੰ ਪਸੰਦ ਕਰਦਾ ਹੈ ਅਤੇ ਉਸ ਨਾਲ ਉਸ ਦੀ ਟਕਨੋਲਜੀ ਵੀ ਵਧੀ ਰਹਿੰਦੀ ਹੈ ਅਤੇ ਔਨਲਾਈਨ ਡਾਂਸ ਵਿੱਚ ਉਹ ਫੁੱਲ ਟਾਈਮ ਵਿੱਚ ਇੰਜੋਏ ਕਰ ਸਕਦਾ ਹੈ ਅਤੇ ਆਪਣੇ ਬੱਚਿਆਂ ਨੂੰ ਵੀ ਕਰਵਾ ਸਕਦਾ ਹੈ ਔਨਲਾਈਨ ਡਾਂਸ ਵਿੱਚ ਉਸ ਨੂੰ ਬਹੁਤ ਹੀ ਚੰਗਾ ਲੱਗਦਾ ਹੈ ਕਿਉਂਕਿ ਇਸ ਨਾਲ ਉਸ ਦਾ ਸਮਾਂ ਚੰਗਾ ਬੀਤਦਾ ਹੈ ਥੈਂਕ ਯੂ